ਕਿਸੇ ਵੀ ਸਮੂਹ ਇਕੱਠ ਦੇ ਵਿੱਚ ਦੌੜਨ ਨਾਲੋਂ ਅਸੀਂ ਪੰਜ ਚਾਰ ਮੁੰਡੇ ਬੰਦੇ ਹੋ ਕੇ ਦੌੜਨਾ ਖੇਡਣਾ ਇਹ ਚੰਗਾ ਵਧੀਆ ਲੱਗਦਾ ਹੈ ਕਿਸੇ ਕਲੱਬ ਵਿੱਚ ਜਿੰਮ ਵਗੈਰਾ ਜਾਂ ਕੋਈ ਹੋਰ ਕਲੱਬ ਵਿੱਚ ਸ਼ਾਮਲ ਹੋਣ ਨਾਲੋਂ ਜਿਵੇਂ ਕੋਈ ਖੇਡ ਹੈ ਵਾਲੀਬਾਲ ਹੈ ਬਾਸਕਿੱਟਬਾਲ ਹੈ ਹੋਰ ਇਹੋ ਜਿਹੇ ਕਲੱਬ ਵਿੱਚ ਸ਼ਾਮਲ ਵਧੀਆ ਹੈ ਉਹ ਖੇਡ ਰਹੇ ਹੈ ਖੇਡਦੇ ਵੀ ਰਹੇ ਇਹ ਬਹੁਤ ਵਧੀਆ ਹੈ ਸਮੂਹ ਅਸੀਂ ਆਪਣੇ ਗਰੁੱਪ ਆ ਜਿਵੇਂ ਪੰਜ ਚਾਰ ਬੰਦਿਆਂ ਦਾ ਗਰੁੱਪ ਹੋ ਜਾਂਦਾ ਉਸੇਵਿੱਚ ਹੀ ਸ਼ਾਮਿਲ ਹੋਣਾ ਉਸ ਵਿੱਚ ਹੀ ਖੇਡਣਾ ਜਿਵੇਂ ਕੋਈ ਵੀ ਗੇਮ ਖੇਡਣੀ ਹੈ ਤਾਂ ਵੀ ਚਾਰ ਪੰਜ ਚਾਰ ਬੰਦੇ ਖੇਡਦੇ ਹਾਂ ਰਲ ਕੇ ਬਾਹਰ ਅੰਦਰ ਜਾਂਦੇ ਹਾਂ ਤਾਂ ਵੀ ਅਤੇ ਸਾਨੂੰ ਵਧੀਆ ਲੱਗਦਾ ਇਹ ਹੀ ਦੌੜਨਾ ਖੇਡਣਾ ਕਸਰਤ ਕਰਨੀ ਸਰੀਰ ਵਾਸਤੇ ਬਹੁਤ ਵਧੀਆ ਖੇਡਣਾ ਵੀ ਬਹੁਤ ਵਧੀਆ ਇਸ ਕਰਕੇ ਸਾਨੂੰ ਨਹੀਂ ਵਧੀਆ ਲੱਗਦਾ ਵੀ ਕਿਸੇ ਇਕੱਠ ਦੇ ਵਿੱਚ ਵਾਹਲੇ ਵੱਡੇ ਇਕੱਠ ਦੇ ਵਿੱਚ ਭੱਜਿਆ ਜਾਵੇ ਜਾਂ ਵਾਹਲੇ ਜਿੰਮ ਵਗੈਰਾ ਜਾਇਆ ਜਾਵੇ ਇਸ ਨਾਲੋਂ ਅਸੀਂ ਖੇਡਾਂ ਨੂੰ ਤਰਜ਼ੀਹ ਦਿੰਦੇ ਹਾਂ ਖੇਡਾਂ ਵਿੱਚ ਪੰਜ ਸੱਤ ਬੰਦੇ ਹੁੰਦੇ ਨੇ ਆਪਣਾ ਗਰੁੱਪ ਹੁੰਦਾ ਉਹਦੇ ਵਿੱਚ ਕੋਈ ਵੱਧ ਘਾਟ ਨਹੀਂ ਹੁੰਦੀ ਕੋਈ ਵਧੀਆ ਹੁੰਦਾ ਹੈ ਅਤੇ ਅਗਾਂਹ ਸਾਡਾ ਲੋੜ ਮੁਤਾਬਿਕ ਸਾਨੂੰ ਤਰਜ਼ੀਹ ਮਿਲਦੀ ਹੈ ਲੋੜ ਮੁਤਾਬਿਕ ਸਾਨੂੰ ਨੌਕਰੀਆਂ ਮਿਲਦੀਆਂ ਖੇਡ ਖੇਡ ਕੇ ਅਸੀਂ ਇੱਕ ਦੂਜੇ ਨਾਲ ਲਿੰਕ ਬਣਾਉਂਦੇ ਹਾਂ ਬਣਾਉਂਦੇ ਹਾਂ ਚਾਹੁੰਦੇ ਹਾਂ ਕਿ ਬਹੁਤ ਵਧੀਆ ਰਹਿੰਦਾ ਹੈ ਇਸ ਕਰਕੇ ਜ਼ਿਆਦਾ ਇਕੱਠ ਦੇ ਵਿੱਚ ਨਹੀਂ ਆਪਣੇ ਗਰੁੱਪ ਦੇ ਵਿੱਚ ਹੀ ਆਪਣਾ ਗਰੁੱਪ ਬਣਾ ਕੇ ਉਸ ਨੂੰ ਵੀ ਇਸਤੇਮਾਲ ਕਰੋ ਉਹਦੇ ਨਾਲ ਖੇਡੋ ਉਹਦੇ ਨਾਲ ਦੌੜੋ ਉਹਦੇ ਨਾਲ ਕਸਰਤ ਕਰੋ ਉਸ ਨਾਲ ਹੀ ਆਓ ਜਾਓ ਅਤੇ ਜਿਹਦੇ ਨਾਲ ਅਸੀਂ ਕਿਤੇ ਵੀ ਅੱਗੇ ਵਧਣਾ ਹੈ ਤਾਂ ਸਾਡੀ ਉਹ ਚੀਜ਼ ਦੇਖ ਕੇ ਸਾਨੂੰ ਤਰਜ਼ੀਹ ਮਿਲੂਗੀ ਸਾਨੂੰ ਫਾਇਦਾ ਮਿਲੂਗਾ ਸੋਚ ਵਧੀਆ ਰੱਖੋ ਕਿਸੇ ਕਲੱਬ ਤੋਂ ਵਗੈਰਾ ਅਸੀਂ ਆਪਣੇ ਕਲੱਬ ਨੂੰ ਹੀ ਤਰਜ਼ੀਹ ਦਿੰਦੇ ਹਾਂ ਸਾਨੂੰ ਉਹ ਵਧੀਆ ਲੱਗਦਾ ਹੈ ਕਿ ਤੁਸੀਂ ਜਿਵੇਂ ਕਹੋਂਗੇ ਠੀਕ ਹੈ ਪਰ ਸਾਨੂੰ ਤਾਂ ਇਹ ਆਪਣਾ ਗਰੁੱਪ ਹੀ ਆਪਣਾ ਕਲੱਬ ਹੀ ਵਧੀਆ ਲੱਗਦਾ ਹੈ